ਸਾਡੀ ਰੋਜ਼ੀ ਰੋਟੀ ਬਿਜਲੀ 'ਤੇ ਨਿਰਭਰ ਕਰਦੀ ਹੈ ਜੀ ਇਹ ਗੱਲ ਸੱਚ ਹੈ ਜਿਵੇਂ ਸਾਨੂੰ ਹੁਣ ਆਪਾਂ ਟੈਕਨੋਲੋਜੀ ਵੱਧ ਰਹੀ ਹੈ ਡੇ ਬਾਏ ਡੇ ਉ ਉਵੇਂ ਸਾਨੂੰ ਬਿਜਲੀ ਦੀ ਆਦਤ ਪੈ ਗਈ ਆ ਪਹਿਲੇ ਵਾਲੇ ਦਿਨਾਂ 'ਚ ਬਿਜਲੀ ਨਹੀਂ ਹੁੰਦਾ ਤਾ ਪਰ ਵੀ ਬੰਦੇ ਰਹਿ ਜਾਂਦੇ ਅਤੇ ਪਰ ਹੁਣ ਡੇ ਬਾਏ ਡੇ ਬਿ ਟੈਕਨੋਲੋਜੀ ਦੇ ਵਧਣ ਕਰਕੇ ਬਿਜਲੀ ਦੇ ਸ ਅਸੀਂ ਆਦੀ ਹੋ ਗਏ ਨੇ ਕਿਉਂਕਿ ਜੇ ਆਪਾਂ ਕੋਈ ਕਿਚਨ 'ਚ ਮੰਨ ਲਓ ਜੇ ਆਪਾਂ ਕਿਚਨ 'ਚ ਗਏ ਕੋਈ ਮਸਾਲਾ ਵੀ ਪੀਸ ਰਹੇ ਵੇ ਮਿਕਸੀ ਮਿਕਸੀ ਦਾ ਯੂਜ ਕਰਦੇ ਨੇ ਮਸਾਲਾ ਪੀਸਣ ਲਈ ਉਹ ਵੀ ਕੀ ਇੱਕ ਬਿਜਲੀ ਦਾ ਯੂਜ਼ ਹੈ ਆਪਾਂ ਕੋਈ ਖਾਣਾ ਫਰੈਸ਼ ਰੱਖਣਾ ਹੈ ਫਰਿੱਜ ਜੇ ਆਪਾਂ ਔਨ ਕਰਿਆ ਉਹ ਵੀ ਕੀ ਬਿਜਲੀ ਨਾਲ ਏ ਚੱਲਦਾ ਹੈ ਕੋਈ ਆਪਾਂ ਮੰਨ ਲਉ ਜੀ ਕੋਈ ਖਾਣਾ ਬਣਾਉਣਾ ਹੈ ਉਹ ਵੀ ਇੱਕ ਬਿਜਲੀ 'ਤੇ ਹੀ ਬਣਦਾ ਬਿਜਲੀ ਵਾਲੇ ਚੁੱਲ੍ਹੇ ਉੱਪਰ ਬਿਜਲੀ ਦਾ ਸਾਡੇ ਜੀਵਨ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਸਾਡੇ ਘਰ ਆ ਜੀ ਇੱਕ ਚੱਕੀ ਲੱਗੀ ਹੋਈ ਹੈ ਬਿਜਲੀ ਬਿਜਲੀ ਦੇ ਰਾਹੀਂ ਉਹ ਸਾਰਾ ਚੱਲਦਾ ਹੈ ਜੀ ਉਹੀ ਸਾਡਾ ਰੋਜ਼ੀ ਰੋਟੀ ਹੈ ਉਸੇ ਕਾਰਨ ਆਪਾਂ ਰੋਜ਼ੀ ਰੋਟੀ ਸਾਡਾ ਚੱਲਦਾ ਹੈ ਬਿਜਲੀ ਦਾ ਕੱਟ ਲੱਗਣ ਨਾਲ ਸਾਨੂੰ ਬਹੁਤ ਪ੍ਰਭਾਵ ਪੈਂਦਾ ਹੈ ਜੋ ਕਿ ਹੈ ਐਂ ਨਹੀਂ ਹੋਣਾ ਚਾਹੀਦਾ ਬਿਜਲੀ ਦਾ ਬਹੁਤ ਮਹੱਤਵ ਹੈ ਸਾਡੀ ਜ਼ਿੰਦਗੀ 'ਚ ਬਿਜਲੀ ਕਰਕੇ ਹੀ ਅੱਗੇ ਵਧੀ ਜਾ ਰਿਹਾ ਲਾਈਟਾਂ ਦਾ ਪੱਖੇ ਦਾ ਹੁਣ ਗਰਮੀਆਂ ਜਿੱਦਾਂ ਮੰਨ ਲਓ ਗਰਮੀ ਆਉਂਦੀ ਹੈ ਇਸ ਗਰਮੀਆਂ 'ਚ ਪੱਖੇ ਪੁੱਖੇ ਬਿਜਲੀ ਏਸੀ ਕੂਲਰ ਸਾਰੇ ਬਿਜਲੀ ਰਾਹੀਂ ਚੱਲਦੇ ਐਂ ਬਿਜਲੀ ਨਾ ਹੋਵੇ ਤਾਂ ਬਹੁਤ ਔਖੀ ਹੈ